ਨਵ ਜੰਮੇ ਬੱਚੇ ਵਾਸਤੇ ਵੈਸੇ ਤਾਂ ਬਹੁਤ ਹੀ ਰਸਮਾਂ ਨਿਭਾਈਆਂ ਜਾਂਦੀਆਂ ਹਨ ਪਰ ਇੱਕ ਨਵ ਜੰਮੇ ਬੱਚੇ ਦਾ ਦੁਨੀਆ 'ਤੇ ਆਉਣਾ ਹੀ ਆਪਣੇ ਆਪ ਦੇ ਵਿੱਚ ਇੱਕ ਕੁਦਰਤ ਦੀ ਦੇਣ ਹੈ ਅਤੇ ਇਹ ਬਹੁਤ ਵਡਮੁੱਲੀਆਂ ਦਾਤਾਂ ਵਾਸਤੇ ਜਿੰਨੀਆਂ ਵੀ ਰਸਮਾਂ ਨਿਭਾਈਆਂ ਜਾਂਦੀਆਂ ਹਨ ਉਹ ਬਹੁਤ ਹੀ ਅਣਮੁੱਲੀਆਂ ਹਨ ਸੋ ਜਿਹੜੀ ਪਹਿਲੀ ਰਸਮ ਬੱਚੇ ਦੇ ਸਵਾ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਕਈ ਘਰਾਂ ਵਿੱਚ ਮਨਾਈ ਜਾਂਦੀ ਹੈ ਉਹ ਹੁੰਦੀ ਹੈ ਜੀ ਨਾਨਕਸ਼ ਨਾਨਕਿਆਂ ਦੀ ਨਾਨਕਿਆਂ ਵੱਲੋਂ ਆਈ ਹੋਈ ਜਿਹੜੀ ਪੰਜੀਰੀ ਅਸੀਂ ਕਹਿ ਦਿੰਦੇ ਹਾਂ ਜਾਂ ਉਨ੍ਹਾਂ ਵੱਲੋਂ ਆਇਆ ਹੋਇਆ ਸਾਰਾ ਸਾਜੋ ਸਮਾਨ ਜਿਹੜਾ ਹੈ ਉਹ ਬੱਚੇ ਵਾਸਤੇ ਅਤੇ ਉਹਦੀ ਬੱਚੇ ਦੀ ਨਵ ਜੰਮੇ ਬੱਚੇ ਦੀ ਮਾਂ ਵਾਸਤੇ ਆਉਂਦਾ ਹੈ ਤਾਂ ਕਿ ਉਹ ਚੰਗੇ ਤਰੀਕੇ ਨਾਲ ਵੱਧ ਫੁੱਲ ਸਕਣ ਫਿਰ ਜੀ ਬਹੁਤ ਸਾਰੇ ਐਸੇ ਤਿਓਹਾਰ ਆਉਂਦੇ ਹਨ ਜਿਨ੍ਹਾਂ ਵਿੱਚ ਬਹੁਤ ਹੀ ਪਹਿਲੀ ਪਹਿਲੀ ਨਵ ਜੰਮੇ ਬੱਚੇ ਦੀ ਰਸਮ ਨਿਭਾਈ ਜਾਂਦੀ ਹੈ ਜਿਹਦੇ ਵਿੱਚ ਕਈਆਂ ਵਿੱਚ ਕ ਨਵ ਜੰਮੇ ਬੱਚਿਆਂ ਵਾਸਤੇ ਬਹੁਤ ਹੀ ਦਾਨ ਪੁੰਨ ਕੀਤੇ ਜਾਂਦੇ ਹਨ ਅਤੇ ਹੋਰ ਵੀ ਕਈ ਐਸੀਆਂ ਰਸਮਾਂ ਨੇ ਜਿਹੜੀਆਂ ਵੱਖੋ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਨਾਈਆਂ ਜਾਂਦੀਆਂ ਹਨ